ਹੈਲੋ ਜੇ ਐਸ ਰਿਜ਼ੋਰਟ ਜੀ ਮੈਂ ਕ੍ਰਿਤਕਾ ਸਿੰਘ ਬੋਲ ਰਹੀ ਹਾਂ ਗ੍ਰੀਨ ਪੈਲੇਸ ਤੋਂ ਜੀ ਮੈਨੂੰ ਨਾ ਚਾਰ ਪੰਜ ਲੋਕਾਂ ਦੇ ਲਈ ਭੋਜਨ ਦਾ ਆਰਡਰ ਦੇਣਾ ਸੀ ਜੇ ਉਸਦੇ ਵਿੱਚ ਤੁਸੀਂ ਸ਼ਾਹੀ ਪਨੀਰ ਦਾਲ ਮੱਖਣੀ ਰਾਜਮਾ ਚਾਵਲ ਕੜ੍ਹਾਹੀ ਪਨੀਰ ਨਾਨ ਅਤੇ ਚਾਵਲ ਦਾਲ ਪਾਪੜ ਅਤੇ ਮਿੱਠੇ ਦੇ ਵਿੱਚ ਮੈਂਗੋ ਹਲਵਾ ਬੂੰਦੀ ਦਾ ਹਲਵਾ ਅਤੇ ਰਸ ਮਲਾਈ ਬਰਫ਼ੀ ਅਤੇ ਪੀਣ ਦੇ ਲਈ ਮੈਂਗੋ ਮਿਲਕ ਸ਼ੇਕ ਅਤੇ ਪੈਪਸੀ ਜੀ ਆਰਡਰ ਦੇ ਵਿੱਚ ਲਿਖ ਲਵੋ ਅਤੇ ਮੈਨੂੰ ਨਾ ਅੱਜ ਚੌਵੀ ਸੱਤ ਦੋ ਹਜ਼ਾਰ ਤੇਈ ਸ਼ਾਮ ਸੱਤ ਵਜੇ ਤੱਕ ਮੈਨੂੰ ਨਾ ਇਹ ਆਰਡਰ ਚਾਹੀਦਾ ਹੈ ਜੀ ਹੋ ਸਕੇ ਤਾਂ ਮੈਨੂੰ ਇਹ ਸੱਤ ਵਜੇ ਤੱਕ ਡਿਲੀਵਰ ਕਰ ਦਿਉ ਤੁਸੀਂ ਅਤੇ ਮੈਂ ਇੰਨਾ ਕੁਝ ਮੰਗਵਾ ਰਹੀਂ ਹਾਂ ਤਾਂ ਕੁਝ ਡਿਸਕਾਊਂਟ ਕੁਛ ਛੂਟ ਜੀ ਧੰਨਵਾਦ